ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਹਾਂਜੀ ਪੋਸਟਪੋਨ ਤਾਂ ਨਹੀਂ ਹੋ ਸਕਦੀ ਪਰ ਤੁਸੀਂ ਕਿਉਂ ਕਰਵਾਉਣੀ ਆ ਓਕੇ ਮੈਮ ਪਰ ਮੈਮ ਨਾ ਟਿਕਟਸ ਪੋਸਟਪੋਨ ਨਹੀਂ ਹੁੰਦੀਆਂ ਤੁਸੀਂ ਇਹਨੂੰ ਕੈਂਸਲ ਕਰਵਾ ਸਕਦੇ ਹੋ ਅਤੇ ਫਿਰ ਤੁਸੀਂ ਜਦੋਂ ਜਾਣਾ ਹੋਇਆ ਉਦੋਂ ਤੁਸੀਂ ਬੁੱਕ ਕਰਵਾ ਲਿਓ ਹਾਂਜੀ ਮੈਡਮ ਜੇ ਤੁਸੀਂ ਚੌਵੀ ਘੰਟੇ ਤੋਂ ਪਹਿਲਾਂ ਟਿਕਟ ਕੈਂਸਲ ਕਰਵਾਉਂਦੇ ਹੋ ਤੁਹਾਨੂੰ ਪੂਰਾ ਪੈਸਾ ਵਾਪਸ ਮਿਲੇਗਾ ਜੇ ਤੁਸੀਂ ਚੌਵੀ ਘੰਟੇ ਬਾਅਦ ਕਰਵਾਉਂਦੇ ਹੋ ਤਾਂ ਤੁਹਾਨੂੰ ਟਵੇਂਟੀ ਫਾਈਵ ਪਰਸੇਂਟ ਮਿਲੇਗਾ ਤੁਸੀਂ ਮੈਮ ਤਤਕਾਲ 'ਚ ਤਾਂ ਨਹੀਂ ਕਰਵਾਈ ਹੋਈ ਟਿਕਟ

ਹਾਂਜੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿਹੜੇ ਤੁਸੀਂ ਕ ਕਿਹੜੇ ਕੋਰਸ ਦੇ ਵਿੱਚ ਹਾਂਜੀ ਇੱਕ ਮਿੰਟ ਤੁਸੀਂ ਲਾਈਨ 'ਤੇ ਬਣੇ ਰਹੋਗੇ ਇੱਕ ਮਿੰਟ ਮੈਂ ਚੈਕ ਕਰਕੇ ਦੱਸ ਦਿੰਦੀ ਹਾਂ ਹਾਂਜੀ ਇਕ ਮਿੰਟ ਰੁਕ ਜਾਓ ਜੀ ਮੈਮ ਹਾਂਜੀ ਮੈਡਮ ਵੇਟਿੰਗ ਹੈ ਪੰਦਰ੍ਹਾਂ ਤਤਕਾਲ ਦੇ ਵਿੱਚ ਤਾਂ ਤੁਹਾਡੀ ਹੋ ਜੂਗੀ ਐਟ ਆ ਟਾਈਮ 'ਤੇ ਹਾਂਜੀ ਤੁਹਾਨੂੰ ਸਵੇਰੇ ਕਰਵਾਉਣੀ ਪੈਣੀ ਤਤਕਾਲ ਦਾ ਸਮਾਂ ਹੁੰਦਾ ਦਸ ਵਜੇ ਦਾ ਸਵੇਰੇ ਦਾ ਉਸ ਦਿਨ ਜਿਸ ਦਿਨ ਤੁਸੀਂ ਜਾਣਾ ਉਸ ਦਿਨ ਤੁਸੀਂ ਤੁਹਾਨੂੰ ਕਰਵਾਉਣੀ ਪੈਣੀ ਤਤਕਾਲ ਦੀ ਜੇ ਤੁਸੀਂ ਹੁਣ ਵੀ ਕਰਵਾਉਂਦੇ ਹੋ ਤਾਂ ਵੀ ਹੋ ਸਕਦਾ ਵੀ ਤੁਹਾਡੇ ਥੋੜ੍ਹੇ ਬਹੁਤ ਚਾਂਸਿਸ ਹੈਗੇ ਵੀ ਤੁਸੀਂ ਤੁਹਾਡੀ ਜਿਹੜੀ ਟਿਕਟ ਆ ਉਹ ਕਨਫਰਮ ਹੋਜੇ ਹਾਂਜੀ ਮੈਡਮ ਇੱਕ ਹੋਰ ਜਾਂਦੀ ਹੈ ਅਤੇ ਉਹਦਾ ਜਿਹੜੀ ਟਾਈਮਿੰਗ ਹੈਗੀ ਆ ਉਹ ਦਸ ਵੀਹ ਦੀ ਆ ਰਾਤ ਨੂੰ ਉਹ ਜੀ ਰਾਤ ਨੂੰ ਪਹੁੰਚਦੀ ਆ ਤ ਤਿੰਨ ਚਾਰ ਵਜੇ ਮਤਲਬ ਸਵੇਰ ਦੇ ਟਾਈਮ 'ਤੇ ਹਾਂਜੀ ਇਕ ਮਿੰਟ ਰੁਕੋ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਇਹਦੇ ਵਿੱਚ ਜੀ ਛੇ ਆ ਵੇਟਿੰਗ ਹਾਂਜੀ ਹਾਂਜੀ ਹੁਣ ਹੋ ਜੂਗੀ ਸਤਾਰ੍ਹਾਂ ਤਾਂ ਕਾਫੀ ਦੂਰ ਪਈ ਹੋਈ ਆ ਅੱਜ ਨੌ ਹੀ ਹੋਈ ਆ ਹਾਂਜੀ ਹਾਂਜੀ ਹਾਂਜੀ ਧੰਨਵਾਦ ਜੀ